ਮੇਰੇ ਮਨ ਵਿੱਚ ਕਾਫੀ ਇੱਛਾ ਸੀ ਡਾਂਸ ਸਿੱਖਣ ਦੀ ਡਾਂਸ ਦੇ ਵਿੱਚ ਮੈਂ ਡਾਂਸ ਤਾਂ ਨਹੀਂ ਕਹੂੰਗਾ ਮਲ ਮਤਲਬ ਭੰਗੜਾ ਜਿਹੜਾ ਮੇਰਾ ਸ ਚਾਅ ਸੀ ਸਿੱਖਣ ਦਾ ਤਾਂ ਉਹ ਮੇਰਾ ਪੂਰਾ ਆ ਕੇ ਹੋਇਆ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਬਠਿੰਡਾ ਦੇ ਵਿੱਚ ਮੈਂ ਸ਼ੁਰੂ ਤੋਂ ਹੀ ਸੀਗਾ ਕਿ ਮੈਂ ਭੰਗੜਾ ਸਿੱਖਣਾ ਹੈ ਪਰ ਉਹ ਮੈਨੂੰ ਮੌਕਾ ਨਹੀਂ ਮਿਲ ਰਿਹਾ ਸੀ ਕੁਛ ਸਮੇਂ ਦੀ ਪਾਬੰਦੀ ਦੀ ਸੀ ਕੁਛ ਕੰਮ ਕਾਰ ਇਦਾਂ ਸੀਗਾ ਕਿ ਜਿਸ ਕਰਕੇ ਮੈਂ ਆਪਣਾ ਭੰਗੜੇ ਦਾ ਸ਼ੌਂਕ ਨਹੀਂ ਪੂਰਾ ਕਰ ਸਕਿਆ ਪਰ ਹਾਂ ਮੈਂ ਆਪਣੇ ਇੱਕ ਕੋਰਸ ਲਈ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਆਇਆ ਅਤੇ ਇੱਥੇ ਆ ਕੇ ਮੈਂ ਆਪਣੇ ਕੋਰਸ ਵਿੱਚ ਪੜ੍ਹ ਹੀ ਰਿਹਾ ਸੀ ਕਿ ਇੰਨੇ ਨੂੰ ਮੈਨੂੰ ਪਤਾ ਲੱਗਦਾ ਕਿ ਸੈਂਟਰਲ ਯੂਨੀਵਰਸਿਟੀ ਪੰਜਾਬ ਦੇ ਵਿੱਚ ਇਹਦਾ ਐਨੂਅਲ ਫੰਕਸ਼ਨ ਹੋਣਾ ਜਿਸ ਦੇ ਵਿੱਚ ਮਤਲਬ ਪੰਦਰਵਾਂ ਐਨੂਅਲ ਫੰਕਸ਼ਨ ਹੋਇਆ ਅਤੇ ਮੈਂ ਇੱਥੇ ਆ ਕੇ ਭੰਗੜੇ ਦੇ ਵਿੱਚ ਜੁਆਇਨ ਕੀਤਾ ਅਤੇ ਮੁੰਡਿਆਂ ਦੀ ਘਾਟ ਸੀ ਮੈਨੂੰ ਆਉਂਦਾ ਨਹੀਂ ਸੀ ਬਿਲਕੁਲ ਵੀ ਅਤੇ ਉੱਥੇ ਭੰਗੜੇ ਦੇ ਵਿੱਚ ਮੁੰਡਿਆਂ ਦੀ ਘਾਟ ਸੀ ਅਤੇ ਮੈਂ ਜੁਆਇਨ ਕੀਤਾ ਭੰਗੜਾ ਅਤੇ ਭੰਗੜਾ ਗਰੁੱਪ ਜੁਆਇਨ ਕੀਤਾ ਅਤੇ ਮੈਨੂੰ ਉਹਨਾਂ ਨੇ ਸਿਖਾਇਆ ਅਤੇ ਮੈਨੂੰ ਇੱਕ ਆਹ ਗੱਲ ਵੀ ਕਹੀ ਕਹਿੰਦਾ ਜੇ ਤੈਨੂੰ ਜੇ ਇੱਥੇ ਮੁੰਡਿਆਂ ਦੀ ਘਾਟ ਨਾ ਹੁੰਦੀ ਨਾ ਤਾਂ ਮੈਂ ਅਸੀਂ ਤੈਨੂੰ ਰੱਖਣਾ ਨਹੀਂ ਸੀ ਅਤੇ ਮੈਂ ਕਿਹਾ ਅੱਛਾ ਫਿਰ ਇੱਦਾਂ ਕਰਕੇ ਮਤਲਬ ਮੇਰਾ ਜਿਹੜਾ ਉਤਸ਼ਾਹ ਸੀ ਥੋੜ੍ਹਾ ਜਿਹਾ ਘੱਟ ਗਿਆ ਸੀ ਪਰ ਇੱਦਾਂ ਸੀ ਮੈਨੂੰ ਸਿੱਖਣ ਦੀ ਲਗਨ ਸੀਗੀ ਭੰਗੜਾ ਮੈਂ ਤਾਂ ਉਰੇ ਆ ਕੇ ਸਿੱਖਿਆ ਅਤੇ ਹੁਣ ਫਿਰ ਮੈਂ ਫਾਈਨਲ ਜਿਹੜਾ ਪ੍ਰੋਪਰ ਤਰੀਕੇ ਨਾਲ ਪ੍ਰੀਪੇਅਰ ਵੀ ਕੀਤਾ ਹਫ਼ਤੇ ਦੇ ਵਿੱਚ ਮੈਂ ਬਹੁਤ ਹੀ ਇੰਪਰੂਵਮੈਂਟ ਕੀਤੀ ਜਿਵੇਂ ਮੈ ਜੀਰੋ ਪਰਸੈਂਟ 'ਤੇ ਸੀ ਤਾਂ ਮੈਂ ਘੱਟੋ ਘੱਟ ਦਸ ਪਰਸੈਂਟ 'ਤੇ ਪਹੁੰਚ ਚੁੱਕਿਆ ਸੀ ਜੀ ਕਿ ਇੰਨਾ ਮੈਂ ਉਰੇ ਆ ਕੇ ਸਿੱਖ ਲਿਆ ਅਤੇ ਉਸ ਤੋਂ ਬਾਅਦ ਫਿਰ ਅ ਸਟੇਜ 'ਤੇ ਕੀਤਾ ਪਹਿਲੀ ਵਾਰ ਮੈਂ ਇੱਧਰ ਭੰਗੜਾ ਵੱਡੇ ਸਟੇਜ 'ਤੇ ਕੀਤਾ ਫਿਰ ਦੂਸਰੀ ਵਾਰ ਮੈਂ ਅਗਲੇ ਮਹੀਨੇ ਹੋਏ ਫੰਕਸ਼ਨ ਦੇ ਵਿੱਚ ਇੱਥੇ ਲੋ ਫੈਸਟ ਸੀ ਉੱਥੇ ਕੀਤਾ ਫਿਰ ਤੀਜਾ ਤੀਜੀ ਵਾਰ ਮੈਂ ਆਪਣੇ ਡੇਸ ਕੋਚਿੰਗ ਜਿੱਥੇ ਮੈਂ ਡੇਸ ਡਿਪਾਰਟਮੈਂਟ 'ਚ ਪੜ੍ਹਦਾ ਉੱਥੇ ਕੀਤਾ ਅਤੇ ਮਤਲਬ ਮੇਰਾ ਬਹੁਤ ਹੀ ਵਧੀਆ ਐਕਸਪੀਰੀਅੰਸ ਰਿਹਾ ਮੈਨੂੰ ਬਹੁਤ ਹੀ ਚੰਗਾ ਲੱਗਾ ਇੱਥੇ ਆ ਕੇ ਅਤੇ ਮਤਲਬ ਮੇਰੇ ਜਿਹੜਾ ਪਿੱਛੇ ਤੋਂ ਚੱਲਦੀ ਆ ਰਹੀ ਡਾਂਸ ਦੀ ਜਾਂ ਭੰਗੜੇ ਦੀ ਜਨੂੰਨ ਸੀ ਇੱਛਾ ਸੀ ਉਹ ਉਰ ਇੱਥੇ ਆ ਕੇ ਪੂਰੀ ਹੋਈ